ਸੋਸ਼ਲ ਮੀਡੀਆ ਦੇ ਉੱਤੇ ਸਭ ਤੋਂ ਪਹਿਲਾਂ ਖਾਤਾ ਮੈਂ ਫੇਸਬੁੱਕ ਦਾ ਬਣਾਇਆ ਸੀਗਾ ਆਪਣੇ ਸਕੂਲ ਟਾਈਮ ਦੇ ਵਿੱਚ ਉਸ ਤੋਂ ਬਆਦ ਇੰਸਟਾਗ੍ਰਾਮ ਦਾ ਦੌਰ ਆਇਆ ਫਿਰ ਮੈਂ ਇੰਸਟਾਗ੍ਰਾਮ ਦੇ ਉੱਤੇ ਇੱਕ ਆਪਣਾ ਖਾਤਾ ਬਣਾਇਆ ਅਤੇ ਅੱਜ ਕੱਲ੍ਹ ਮੈਂ ਟਵੀਟਰ ਦੇ ਉੱਤੇ ਵੀ ਇੱਕ ਖਾਤਾ ਬਣਾਇਆ ਹੋਇਆ ਹੈ ਸੋਸ਼ਲ ਮੀਡੀਆ ਦੇ ਇਹਨਾਂ ਖਾਤਿਆਂ ਦੀ ਸਭ ਤੋਂ ਵੱਧ ਮਦਦ ਮੈਨੂੰ ਇਹ ਮਿਲੀ ਕਿ ਜਿਹੜੇ ਸਕੂਲ ਦੇ ਮੇਰੇ ਦੋਸਤ ਸੀ ਜਿਹੜੇ ਮੇਰੇ ਨਾਲ ਤੋਂ ਵਿਛੜ ਗਏ ਸੀਗੇ ਜਿਹਨਾਂ ਦੇ ਨਾਲ ਮੇਰਾ ਨਹੀਂ ਕੋਟੈਂਕਟ ਸੀਗਾ ਸੋ ਸੋਸ਼ਲ ਮੀਡੀਆ ਦੇ ਇਹਨਾਂ ਖਾਤਿਆਂ ਦੇ ਨਾਲ ਮੈਂ ਉਹਨਾਂ ਦੇ ਨਾਲ ਕੋਟੈਂਕਟ ਰੱਖ ਸਕਦੀ ਹਾਂ ਆਪਣਾ ਉਸ ਤੋਂ ਇਲਾਵਾ ਆਪਣੇ ਕੋਈ ਵੀ ਜਾਣਕਾਰੀ ਹੈ ਜਿਵੇਂ ਕਿ ਕਿਸੇ ਬਿਜ਼ਨਸ ਦੀ ਜਾਣਕਾਰੀ ਹੋਵੇ ਈਵਨ ਅੱਜ ਕੱਲ੍ਹ ਸ਼ੋਪਿੰਗ ਵੀ ਹੈ ਜਿਹੜਾ ਮੈਂ ਨਾ ਸੋਸ਼ਲ ਮੀਡੀਆ ਦੇ ਖਾਤਿਆਂ ਦੀ ਹੈਲਪ ਦੇ ਨਾਲ ਕਰ ਰਹੀ ਹਾਂ ਜਿਵੇਂ ਕੋਈ ਕੋਈ ਸੂਟ ਲੈਣਾ ਹੋਵੇ ਜਾਂ ਕੋਈ ਵੀ ਇੱਦਾਂ ਦੀ ਕੋਈ ਚੀਜ਼ ਹੈ ਸੋ ਇਹਨਾਂ ਸੋਸ਼ਲ ਮੀਡੀਆ ਦੇ ਨਾਲ ਮੈਂ ਆਪਣੇ ਦੋਸਤਾਂ ਦੇ ਨਾਲ ਕੋਟੈਂਕਟ ਵੀ ਰੱਖ ਸਕਦੀ ਹਾਂ ਸ਼ੋਪਿੰਗ ਵੀ ਕਰ ਸਕਦੀ ਹਾਂ ਸੋ ਉਸ ਤੋਂ ਇਲਾਵਾ ਕਹਿ ਲਓ ਜਿਵੇਂ ਅੱਜ ਕੱਲ੍ਹ ਮੇਰੇ ਦੋਸਤਾਂ ਦੀਆਂ ਜ਼ਿੰਦਗੀ ਦੇ ਵਿੱਚ ਕੀ ਕੁਛ ਨਵਾਂ ਹੋ ਰਿਹਾ ਹੈ ਉਹ ਸਭ ਮੇਰੇ ਨਾਲ ਸ਼ੇਅਰ ਕਰਦੇ ਹਨ ਜਾਂ ਫਿਰ ਮੇਰੀ ਆਪਣੀ ਜ਼ਿੰਦਗੀ ਦੇ ਵਿੱਚ ਕੀ ਨਵਾਂ ਹੋ ਰਿਹਾ ਹੈ ਉਹ ਮੈਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਸਕਦੀ ਹਾਂ ਫੋਟੋਜ਼ ਵਗੈਰਾ ਹੈ ਜਿਹੜੀਆਂ ਉਹ ਮੈਂ ਉਹਨਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹਾਂ